ਮੈਂ ਖੋ ਖੋ ਦੀ ਖੇਡ ਖੇਡਦੀ ਰਹੀ ਹਾਂ ਇਸਦੇ ਵਿੱਚ ਬਹੁਤ ਜ਼ਿਆਦਾ ਸਟੈਮੀਨੇ ਦੀ ਜ਼ਰੂਰਤ ਹੁੰਦੀ ਹੈ ਮੈਂ ਗੇਮ ਤਾਂ ਅੱਛੀ ਖੇਡ ਪਾਉਂਦੀ ਸੀ ਪਰ ਜਲਦੀ ਥੱਕ ਜਾਂਦੀ ਸੀ ਸਟੈਮੀਨਾ ਘੱਟ ਹੋਣ ਕਰਕੇ ਇਹ ਖੇਡ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਲੱਗਦੀ ਸੀ ਮੈਂ ਹਰ ਟਾਇਮ ਨਿਰਾਸ਼ਾ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਇੱਕ ਦਿਨ ਦ੍ਰਿੜ ਨਿਸ਼ਚੇ ਦੇ ਨਾਲ ਆਪਣੀ ਖੁਰਾਕ ਅਤੇ ਐਕਸਰਸਾਈਜ਼ 'ਤੇ ਧਿਆਨ ਦਿੱਤਾ ਅਤੇ ਹੌਲੀ ਹੌਲੀ ਇਸ ਦੇ ਵਿੱਚੋਂ ਉਭਰਨਾ ਸ਼ੁਰੂ ਕੀਤਾ ਸਮਾਂ ਪਾ ਕੇ ਮੇਰਾ ਸਟੈਮੀਨਾ ਵੀ ਠੀਕ ਹੋ ਗਿਆ ਅਤੇ ਜਿਹੜੀ ਮੈਂ ਨਿਰਾਸ਼ਾ ਚੱਲ ਰਹੀ ਸੀ ਇਸ ਗੇਮ ਦੇ ਪ੍ਰਤੀ ਮੈਨੂੰ ਲੱਗਦਾ ਸੀ ਕਿ ਮੈਂ ਕਦੀ ਇਹਨੂੰ ਖੇਡ ਹੀ ਨਹੀਂ ਪਾਊਂਗੀ ਮੈਂ ਉਹਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਜਿਹੜਾ ਖੇਡ ਸਕੀ